ਸੋਲਾਂ ਮਾਰਚ ਵੀਹ ਬਾਈ ਸਤਾਰਾਂ ਜਨਵਰੀ ਅਠਾਰਾਂ ਛਿਆਲੀ ਪੰਦਰਾਂ ਫਰਵਰੀ ਉੱਨੀ ਪੰਝੱਤਰ ਸੋਲਾਂ ਮਈ ਵੀਹ ਤੇਈ ਸਤਾਰਾਂ ਦਸੰਬਰ ਅਠਾਰਾਂ ਛਿਆਹਠ